ਇਹੋ ਜਿਹੇ ਕਈ ਵਹਿਮ ਭਰਮ ਹੈਗੇ ਆ ਜਿਹਨਾਂ 'ਤੇ ਵਿਸ਼ਵਾਸ ਕੀਤਾ ਜਾਂਦਾ ਨਾ ਚਾਹੁੰਦੇ ਹੋਏ ਵੀ ਜਿਵੇਂ ਕਿ ਬਿੱਲੀ ਰਸਤਾ ਕੱਟ ਗਈ ਹੁਣ ਆਪਾਂ ਨੂੰ ਪਤਾ ਹੈ ਕਿ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਕਾਲੀ ਬਿੱਲੀ ਜੇ ਰਸਤਾ ਕੱਟ ਜਾਂਦੀ ਹੁੰਦੀ ਸੀ ਉਹ ਕਿਉਂ ਹੁੰਦਾ ਸੀਗਾ ਰਾਤ ਨੂੰ ਬੱਲਦਾਂ 'ਤੇ ਜਾਂਦੇ ਹੁੰਦੇ ਸੀ ਅਤੇ ਜੇ ਸਾਹਮਣੋ ਦੀ ਬਿੱਲੀ ਕੱਟ ਜੇ ਉਹਦੀਆਂ ਅੱਖਾਂ ਚਮਕਦੀਆਂ ਹੁੰਦੀਆਂ ਸੀਗੀਆਂ ਤਾਂ ਅੱਖਾਂ ਨੂੰ ਦੇਖ ਕੇ ਬਲਦ ਡਰ ਜਾਂਦੇ ਹਫੜਾ ਦਫੜੀ ਮਚਾਉਂਦੇ ਨੁਕਸਾਨ ਹੁੰਦਾ ਤਾਂ ਕਰਕੇ ਕਹਿੰਦੇ ਕਿ ਬਿੱਲੀ ਰਸਤਾ ਕੱਟ ਗਈ ਉਹਨਾਂ ਨੇ ਵਹਿਮ ਹੀ ਬਣਾ ਲਿਆ ਹੁਣ ਜਿਹਨਾਂ ਨੇ ਕਾਲੀਆਂ ਬਿੱਲੀਆਂ ਪਾਲੀਆਂ ਹੋਈਆਂ ਉਹਨਾਂ ਨੂੰ ਵੀ ਪੁੱਛੋ ਉਹਨਾਂ ਦਾ ਤਾਂ ਇੱਦਾਂ ਕੁਛ ਹੁੰਦਾ ਨਹੀਂ ਗਾ ਉਹਨਾਂ ਦਾ ਤਾਂ ਰੋਜ਼ ਹੀ ਕੱਟਦੀਆਂ ਹੋਣੀਆਂ ਰਸਤਾ ਅਤੇ ਮੈਂ ਕਿਹੜੇ ਹੀ ਵਹਿਮ 'ਤੇ ਵਿਸ਼ਵਾਸ ਕਰੂੰਗੀ ਕੁਛ ਕੁਛ ਹੈਗੇ ਹੈ ਜਿਹਨਾਂ 'ਤੇ ਹੁੰਦਾ ਪਰ ਜ਼ਿਆਦਾ ਤਾਂ ਨਹੀਂ ਹੈਗਾ ਮੈਨੂੰ ਲੱਗਦਾ ਔਰ ਕਿਹੜੇ ਹੀ ਹੋਣਗੇ ਕਹਿੰਦੇ ਵੀਰਵਾਰ ਸਿਰ ਨਹੀਂ ਧੋਣਾ ਇੱਦਾਂ ਨਹੀਂ ਕਰੀਦਾ ਉਹ ਸਾਰਾ ਕੁਝ ਨਾ ਵਿਸ਼ਵਾਸ ਨਹੀਂ ਕਰੀਦਾ ਹੁੰਦਾ ਛਿੱਕ 'ਤੇ ਜ਼ਰੂਰ ਹੁੰਦਾ ਹੈਗਾ ਕਿ ਛਿੱਕਾਂ ਆਉਣ 'ਤੇ ਥੋੜ੍ਹੀ ਦੇਰ ਰੁਕ ਜੋ ਜਾਂ ਪਿੱਛੋਂ ਆਵਾਜ਼ ਨਹੀਂ ਮਾਰੀਦੀ ਹੁੰਦੀ ਉਸ 'ਤੇ ਮੈਂ ਵਿਸ਼ਵਾਸ ਕਰਦੀ ਹਾਂ ਕਿ ਕੋਈ ਜਾ ਰਿਹਾ ਤਾਂ ਪਿੱਛੋਂ ਆਵਾਜ਼ ਨਹੀਂ ਮਾਰੀਦੀ ਹੁੰਦੀ